ਭੰਗੜਾ ਅਤੇ ਐਰੋਬਿਕਸ ਕਰਨ ਤੋਂ ਬਾਅਦ ਸਾਡੀ ਸਰੀਰਿਕ ਅਤੇ ਮਾਨਸਿਕ ਭਾਵਨਾ ਬਦਲ ਜਾਂਦੀ ਹੈ ਅਸੀਂ ਅ ਆਪਣੇ ਆਪ ਵਿੱਚ ਕਾਫੀ ਤਾਜ਼ਾ ਮਹਿਸੂਸ ਕਰਦੇ ਹਨ ਇਹ ਸਿਰਫ ਇੱਕ ਕਸਰਤ ਨਹੀਂ ਬਲਕਿ ਸਰੀਰ ਅਤੇ ਮਨ ਦੋਵਾਂ ਲਈ ਊਰਜਾ ਦਾ ਇੱਕ ਸ਼ਾਨਦਾਰ ਸਰੋਤ ਹੈ ਭੰਗੜਾ ਕਰਨ ਨਾਲ ਸਾਡੀ ਸਰੀਰਕ ਤਾਕਤ ਵੱਧਦੀ ਹੈ ਇਹ ਪੂਰੇ ਬੋਡੀ ਦਾ ਵਰਕਆਊਟ ਹੈ ਜੋ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਇੱਕ ਕਸਰਤ ਦਾ ਵੀ ਕੰਮ ਕਰਦਾ ਹੈ ਜਿਹਦੇ ਨਾਲ ਸਾਡੇ ਸਰੀਰ ਵਿੱਚ ਤੰਦਰੁਸਤੀ ਵੱਧਦੀ ਹੈ ਦਿਲ ਦੀ ਗਤੀ ਤੇਜ਼ ਹੁੰਦੀ ਹੈ ਜਿਸ ਨਾਲ ਲਹੂ ਦਾ ਸੰਚਾਰ ਵਧੀਆ ਹੁੰਦਾ ਹੈ ਐਰੋਬਿਕਸ ਵੀ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੀ ਹੈ ਕੈਲਰੀਜ਼ ਘਟਾਉਂਦੀ ਹੈ ਅਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਵਿੱਚ ਕਾਫੀ ਸਹਾਇਤਾ ਕਰਦੀ ਹੈ ਅਤੇ ਸਾਡੇ ਲੰਬੇ ਸਮੇਂ ਤੱਕ ਕੰਮ ਕਰਨ ਨੂੰ ਸਾਨੂੰ ਪ੍ਰੋਤਸ਼ਾਹਿਤ ਵੀ ਕਰਦੀ ਹੈ ਪਰ ਸਿਰਫ ਸਰੀਰਕ ਫਾਇਦੇ ਹੀ ਨਹੀਂ ਹਨ ਇਹ ਮਾਨਸਿਕ ਤੌਰ 'ਤੇ ਵੀ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ ਜਦੋਂ ਅਸੀਂ ਭੰਗੜਾ ਜਾਂ ਐਰੋਬਿਕਸ ਕਰਦੇ ਹਾਂ ਸਾਡੇ ਦਿਮਾਗ ਵਿੱਚ ਖੁਸ਼ੀ ਦੇ ਹਾਰਮੋਨ ਨਿਕਲਦੇ ਹਨ ਜੋ ਤਣਾਅ ਅਤੇ ਚਿੰਤਾ ਨੂੰ ਘਟਾਉਂਦਾ ਹੈ ਇਸ ਨਾਲ ਅਸੀਂ ਆਪਣੇ ਆਪ ਨੂੰ ਖੁ ਖੁਸ਼ ਅਤੇ ਆਤਮ ਵਿਸ਼ਵਾਸੀ ਅਤੇ ਉਤਸ਼ਾਹਿਤ ਮਹਿਸੂਸ ਕਰਦੇ ਹਨ ਸਭ ਤੋਂ ਵਧੀਆ ਗੱਲ ਇਹ ਹੈ ਕਿ ਦੋਵੇਂ ਸਰਗਰਮੀਆਂ ਮਜ਼ੇਦਾਰ ਵੀ ਹਨ ਭੰਗੜੇ ਦੀ ਧੁਨ 'ਤੇ ਨੱਚਣ ਨਾਲ ਸਾਡੀ ਊਰਜਾ ਵੱਧਦੀ ਹੈ ਜਦਕਿ ਐਰੋਬਿਕਸ ਨਾਲ ਸਾਡੇ ਸਰੀਰ ਵਿੱਚ ਵਧੀਆ ਮੂਵਮੈਂਟ ਹੁੰਦੀ ਹੈ ਭੰਗੜਾ ਪੰਜਾਬ ਦਾ ਕਾਫੀ ਪੁਰਾਣਾ ਇੱਕ ਗੀਤ ਉੱਤੇ ਕਰਨ ਵਾਲਾ ਡਾਂਸ ਵੀ ਹੈ ਜਿਸ ਨਾਲ ਸਾਨੂੰ ਕਾਫੀ ਜ਼ਿਆਦਾ ਸਿਹਤ ਵਾਈਜ ਫਾਇਦਾ ਹੁੰਦਾ ਹੈ ਅਤੇ ਭੰਗੜਾ ਕਰਨ ਨਾਲ ਆਪਾਂ ਕਾਫੀ ਤੰਦਰੁਸਤ ਮਹਿਸੂਸ ਵੀ ਕਰਦੇ ਹਨ ਐਰੋਬਿਕਸ ਵੀ ਸਾਨੂੰ ਤੰਦਰੁਸਤ ਰੱਖਣ ਵਿੱਚ ਕਾਫੀ ਸਹਾਇਤਾ ਕਰਦੀ ਹੈ